ਮੇਰਾ ਸਭ ਤੋਂ ਯਾਦਗਾਰ ਬਾਈਕਿੰਗ ਅਨੁਭਵ ਲੇਹ ਲਦਾਖ ਟੂਰ ਸੀ ਜਿਸ ਵਿੱਚ ਮੈਂ ਅਤੇ ਮੇਰੇ ਦੋਸਤ ਲਗਭਗ ਦਸ ਬਾਈਕ 'ਤੇ ਪੰਜਾਬ ਤੋਂ ਸ੍ਰੀਨਗਰ ਹੁੰਦੇ ਹੋਏ ਲੇਹ ਲਦਾਖ ਤੱਕ ਦਾ ਸਫਰ ਕੀਤਾ ਇਹ ਸਫਰ ਬਹੁਤ ਹੀ ਖਾਸ ਸੀ ਜੋ ਕਿ ਅਸੀਂ ਬਹੁਤ ਸਾਰੇ ਪਹਾੜ ਜਿੱਥੇ ਕਿ ਬਾਈਕ ਨਹੀਂ ਜਾ ਸਕਦੀ ਸੀ ਉੱਥੇ ਤੱਕ ਅਸੀਂ ਰਾਈਡਿੰਗ ਕੀਤੀ ਅਤੇ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਰੁਕ ਕੇ ਅਸੀਂ ਬਾਈਕ ਨੂੰ ਖੜ੍ਹਾ ਕਰਕੇ ਬਹੁਤ ਸਾਰੀਆਂ ਯਾਦਗਾਰ ਪਿਕਚਰ ਫੋਟੋਆਂ ਖਿੱਚੀਆਂ ਅਤੇ ਵੀਡੀਓ ਵੀ ਬਣਾਈ